ਪੰਜਾਬ ਵਿੱਚ ਕਈ ਪਸ਼ੂ ਪਾਲੇ ਜਾਂਦੇ ਹਨ ਜਿਹਨਾਂ 'ਚੋਂ ਗਾਂ ਮੱਝ ਅ ਬੱਕਰੀ ਮਹੱਤਵਪੂਰਨ ਹਨ ਇਹ ਸ ਪੰਛੀ ਇ ਇਹ ਅ ਪਸ਼ੂ ਸਾਨੂੰ ਦੁੱਧ ਦਿੰਦੇ ਹਨ ਇਹਨਾਂ ਦਾ ਦੁੱਧ ਬਹੁਤ ਵਧੀਆ ਹੁੰਦਾ ਹੈ ਪੰਜਾਬ 'ਚ ਗਾਵਾਂ ਦਾ ਦੁੱਧ ਬਹੁਤ ਵਧੀਆ ਹੁੰਦਾ ਹੈ ਉਹ ਬੱਚਿਆਂ ਵਾਸਤੇ ਅਤੇ ਵੱਡਿਆਂ ਵਾਸਤੇ ਬਜ਼ੁਰਗਾਂ ਵਾਸਤੇ ਬਹੁਤ ਵਧੀਆ ਹੁੰਦਾ ਹੈ ਅਤੇ ਇਹਨਾਂ ਦੇ ਇਹਨਾਂ ਦੇ ਗੋਬਰ ਇਹਨਾਂ ਦਾ ਗੋਬਰ ਵੀ ਬਹੁਤ ਮਹੱਤਵਪੂਰਨ ਹੁੰਦਾ ਹੈ ਇਹਨਾਂ ਦੇ ਗੋਬਰ ਦੇ ਨਾਲ ਅ ਪਿੰਡਾਂ 'ਚ ਵਿੱਚ ਅ ਉਪਲੇ ਬਣਾਏ ਜਾਂਦੇ ਹਨ ਜੋ ਕਿ ਜਲਾਉਣ ਦੇ ਕੰਮ ਆਉਂਦੇ ਹਨ ਅਤੇ ਬੱਕਰੀ ਦਾ ਦੁੱਧ ਬਹੁਤ ਹੀ ਤਾਕਤਵਰ ਹੁੰਦਾ ਹੈ ਜੇਕਰ ਕਿਸੇ ਨੂੰ ਕੋਈ ਬਿਮਾਰੀ ਹੋਵੇ ਜਾਂ ਅ ਕਿਸੇ ਦੇ ਸੈੱਲ ਘੱਟ ਜਾਣ ਤਾਂ ਉਹ 'ਚ ਬੱਕਰੀ ਦਾ ਦੁੱਧ ਬਹੁਤ ਅ ਕੰਮ ਕਰਦਾ ਹੈ ਸੈਲ ਘਟਣ ਦਾ ਸੈਲ ਘਟਣ ਨਾਲ ਅ ਬੰਦਾ ਬਿਮਾਰ ਰਹਿੰਦਾ ਹੈ ਅਤੇ ਬੱਕਰੀ ਦਾ ਦੁੱਧ ਪੀਣ ਨਾਲ ਉਹ ਸੈਲ ਪੂਰੇ ਹੋ ਜਾਂਦੇ ਹਨ ਅਤੇ ਇਨ ਪਸ਼ੂਆਂ ਦਾ ਦੁੱਧ ਪੀਣ ਨਾਲ ਪੰਜਾਬ 'ਚ ਅੱਛੀ ਅੱਛੀ ਤਰ੍ਹਾਂ ਜੀਵਨ ਜੀਅ ਸਕਦੇ ਹਨ ਅਤੇ ਪਸ਼ੂ ਸਾਨੂੰ ਕਈ ਤਰ੍ਹਾਂ ਦੇ ਫਾਇਦੇ ਦਿੰਦੇ ਹਨ ਪਸ਼ੂ ਸਾਨੂੰ ਵਧੀਆ ਤੋਂ ਵਧੀਆ ਦੁੱਧ ਦਿੰਦੇ ਹਨ ਅਤੇ ਅ ਉਹ ਦੁੱਧ ਸਾਡੇ ਸਿਹਤ ਲਈ ਬਹੁਤ ਅੱਛਾ ਹੁੰਦਾ ਹੈ ਅਤੇ ਦੁੱਧ ਪੀਣ ਨਾਲ ਸਾਡੀ ਅਸ ਸਿਹਤ ਅੱਛੀ ਰਹਿੰਦੀ ਹੈ ਅਤੇ ਪੰਜਾਬ ਵਿੱਚ ਪਸ਼ੂਆਂ ਨੂੰ ਪਾਲਣਾ ਇੱਕ ਬਹੁਤ ਹੀ ਮਹੱਤਵਪੂਰਨ ਗੱਲ ਹੈ ਜੇਕਰ ਪਸ਼ੂ